ਹੈਲੋ ਹੈਲੋ ਹਾਂਜੀ ਨਮਸਕਾਰ ਜੀ ਹਾਂਜੀ ਮੈਂ ਦੀਪਿਕਾ ਗੱਲ ਕਰਦੀ ਪਈ ਹਾਂ ਹਾਂਜੀ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਤੇ ਮੈਂ ਤੁਹਾਡੇ ਤੋਂ ਇੱਕ ਸਲਾਹ ਮੰਗਣੀ ਸੀ ਕਿ ਜਿਵੇਂ ਤੁਸੀਂ ਫਾਰਮਰ ਹੋ ਹਾਂਜੀ ਅਤੇ ਮਤਲਬ ਕਿ ਸਮਾਂ ਹੁਣ ਗਰਮੀਆਂ ਦੇ ਸੀਜ਼ਨ 'ਚ ਅਸੀਂ ਕਿਹੜੀ ਕਿਹੜੀ ਫ਼ਸਲਾਂ ਸਹੀ ਤਰੀਕੇ ਨਾਲ ਲਗਾ ਸਕਦੇ ਹਾਂ ਜਿਨ੍ਹਾਂ ਨੂੰ ਮਤਲਬ ਸਾਡੇ ਪੈਸੇ ਵੀ ਘੱਟ ਲੱਗਣ ਅਤੇ ਸਾਡੀ ਬੱਚਤ ਵੀ ਹੋਏ ਅਤੇ ਫ਼ਸਲ ਵੀ ਕਾਫੀ ਚੰਗੀ ਹੋਏ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਠੀਕ ਹੈ ਮਤਲਬ ਜਿਵੇਂ ਕਿ ਜਗ੍ਹਾ ਸਾਡੇ ਕੋਲ ਘੱਟ ਹੋਏ ਜਗ੍ਹਾ ਘੱਟ ਹੋਏ ਅਤੇ ਫ਼ਸਲ ਵੀ ਸਾਡੀ ਸਹੀ ਹੋ ਸਕੇ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਇਹਨਾਂ ਨੂੰ ਲਗਾਉਣ ਦੇ ਮਤਲਬ ਕਿੰਨਾ ਕੁ ਲਾਗਤ ਕਿੰਨੀ ਕੁ ਆਉਂਦੀ ਹੈ ਇਨ੍ਹਾਂ ਨੂੰ ਲਗਾਉਣਾ ਹੋਏ ਤਾਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਅਤੇ ਠੀਕ ਹੈ ਠੀਕ ਹੈ ਮਤਲਬ ਸਾਨੂੰ ਮੁਨਾਫ਼ਾ ਵੀ ਕਾਫੀ ਜ਼ਿਆਦਾ ਹੋ ਸਕਦਾ ਹੈ ਜਿੱਦਾਂ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਨਹੀਂ ਨਹੀਂ ਜਗ੍ਹਾ ਤਾਂ ਉਹ ਉੱਨੀ ਕੁ ਹੈ ਬਟ ਉਸ ਹਿਸਾਬ ਨਾਲ ਮੈਂ ਦੇਖਿਆ ਜਾਏ ਮੈਂ ਕਿਹਾ ਕਿੱਦਾਂ ਜਗ੍ਹਾ ਵੀ ਥੋੜੀ ਘੱਟ ਹੀ ਹੈ ਅਤੇ ਸਾਨੂੰ ਮੁਨਾਫ਼ਾ ਵੀ ਥੋੜ੍ਹਾ ਹੋ ਸਕੇ ਹੈ ਨਾ ਜਿੱਦਾਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਜੀ